ਮੈਂ ਲੁਧਿਆਣਾ ਅਤੇ ਅੰਬਾਲਾ ਦੇ ਥੋਕ ਬਜ਼ਾਰਾਂ ਬਾਰੇ ਜਾਣਦੀ ਹਾਂ ਜਿੱਥੇ ਕਿ ਕੱਪੜੇ ਕਾਫ਼ੀ ਥੋਕ ਰੇਟਾਂ ਉੱਤੇ ਮਿਲਦੇ ਹਨ ਆਮ ਜਨਤਾ ਤੋਂ ਇਲਾਵਾ ਇੱਥੇ ਜ਼ਿਆਦਾਤਰ ਦੁਕਾਨਦਾਰ ਜ਼ਿਆਦਾ ਖਰੀਦਦਾਰੀ ਕਰਦੇ ਹਨ ਜੋ ਕਿ ਉੱਥੋ ਥੋਕ ਦਾ ਮਾਲ ਲਿਆ ਕੇ ਆਪਣੀ ਦੁਕਾਨਾਂ 'ਤੇ ਵੇਚਦੇ ਹਨ ਜਿਸ ਨਾਲ ਉਹਨਾਂ ਨੂੰ ਕਾਫ਼ੀ ਮੁਨਾਫਾ ਹੁੰਦਾ ਹੈ ਕਰਿਆਨਾ ਔਰ ਸਬਜ਼ੀ ਦੀਆਂ ਕੀਮਤਾਂ ਪਿਛਲੇ ਕੁਛ ਸਾਲਾਂ ਵਿੱਚ ਕਾਫ਼ੀ ਬਦਲੀਆਂ ਹਨ ਇਸਦਾ ਸਭ ਤੋਂ ਬੜਾ ਕਾਰਨ ਹੈ ਕੋਵਿਡ ਮਹਾਂਮਾਰੀ ਜਿਸਦਾ ਪੂਰੇ ਦੇਸ਼ 'ਤੇ ਕਾਫ਼ੀ ਅਸਰ ਹੋਇਆ ਹੈ ਸਭ ਤੋਂ ਜ਼ਿਆਦਾ ਅਸਰ ਕਰਿਆਨੇ ਅਤੇ ਸਬਜ਼ੀਆਂ ਦੀਆਂ ਕੀਮਤਾਂ ਉੱਤੇ ਹੋਇਆ ਹੈ ਜਿਸਦਾ ਕਾਫ਼ੀ ਨੁਕਸਾਨ ਆਮ ਜਨਤਾ ਨੂੰ ਹੋਇਆ ਹੈ ਅਤੇ ਨਾਲ ਹੀ ਨਾਲ ਸਾਡੇ ਕਿਸਾਨਾਂ ਨੂੰ ਵੀ ਹੋਇਆ ਹੈ ਇਸ ਵਿੱਚ ਤਬਦੀਲੀ ਲਿਆਉਣ ਲਈ ਸ ਸਰਕਾਰ ਨੇ ਕਾਫ਼ੀ ਕਦਮ ਉਠਾਏ ਹਨ ਜਿਨ੍ਹਾਂ ਤਬਦੀਲੀਆਂ ਕਰ ਕਾਰਨ ਇਹਨਾਂ ਦੀਆਂ ਕੀਮਤਾਂ ਵਿੱਚ ਵੀ ਕਾਫ਼ੀ ਬਦਲਾਵ ਆਇਆ ਹੈ ਔਨਲਾਈਨ ਖਰੀਦਦਾਰੀ ਅੱਜ ਕੱਲ੍ਹ ਕਾਫ਼ੀ ਆਮ ਹੋ ਚੁੱਕੀ ਹੈ ਹਰ ਆਮ ਇਨਸਾਨ ਔਨਲਾਈਨ ਔਰਡਰ ਕਰਦਾ ਹੀ ਹੈ ਔਨਲਾਈਨ ਅਸੀਂ ਘਰ ਬੈਠੇ ਹੀ ਆਪਣੀ ਮਨਪਸੰਦ ਦਾ ਸਮਾਨ ਮਨ ਪਸੰਦ ਕਰਕੇ ਔਨਲਾਈਨ ਔਡਰ ਕਰ ਸਕਦੇ ਹਾਂ ਜੋ ਕਿ ਸਾਨੂੰ ਬਿਨਾਂ ਘਰ ਤੋਂ ਬਾਹਰ ਜਾਏ ਸਾਨੂੰ ਘਰ ਹੀ ਪਹੁੰਚਾ ਦਿੱਤਾ ਜਾਂਦਾ ਹੈ ਲੋਕ ਇਸਨੂੰ ਕਾਫ਼ੀ ਮਹੱਤਵ ਦੇਣ ਲੱਗ ਗਏ ਹਨ ਇਸ ਦੀਆਂ ਚੰਗੀਆਂ ਆਦ ਚੰਗੀਆਂ ਚੀਜ਼ਾ ਨੂੰ ਦੇਖਦੇ ਦੇਖਦੇ ਹੀ ਇਸਦੀਆਂ ਕੁਛ ਮਾੜੀਆਂ ਚੀਜ਼ਾਂ ਵੀ ਹਨ ਜਿਵੇਂ ਕਿ ਜਿਸ ਜਿਸ ਤਰ੍ਹਾਂ ਫ਼ੋਨ ਵਿੱਚ ਦਿਖਾਇਆ ਜਾਂਦਾ ਹੈ ਕਈ ਵਾਰ ਸਮਾਨ ਉਸ ਤਰ੍ਹਾਂ ਨਹੀਂ ਮਿਲਦਾ ਉਸਦੀ ਕੁਆਲੀਟੀ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ ਅਤੇ ਜਿਸ ਹਿਸਾਬ ਨਾਲ ਫੋਟੇ ਵਿੱਚ ਦਿਖਾਇਆ ਜਾਂਦਾ ਹੈ ਉਸ ਤੋਂ ਕਾਫ਼ੀ ਅਲੱਗ ਹੁੰਦਾ ਹੈ